ਜੇਕਰ ਮੈਂ ਆਪਣੀਆਂ ਜ਼ਿੰਦਗੀ ਦੇ ਤਜ਼ਰਬੇ 'ਚ ਕਿਤਾਬਾਂ ਦੀ ਗੱਲ ਕਰਾਂ ਤਾਂ ਮੈਂ ਬਹੁਤ ਸਾਰੀਆਂ ਕਿਤਾਬਾਂ ਪੜ੍ਹੀਆਂ ਨੇ ਪਰ ਇਹਨਾਂ ਵਿੱਚੋਂ ਮੈਂ ਕਦੇ ਵੀ ਇਹ ਨਹੀਂ ਸੀ ਸੋਚਿਆ ਕਿ ਮੈਂ ਇਲੈੱਕਟਿਵ ਪੰਜਾਬੀ ਵੀ ਪੜ੍ਹਾਂਗੀ ਕਿਉਂਕਿ ਇਲੈੱਕਟਿਵ ਪੰਜਾਬੀ ਮੈਨੂੰ ਬਹੁਤ ਹੀ ਜ਼ਿਆਦਾ ਔਖੀ ਲੱਗਦੀ ਸੀ ਉਹਦੇ ਵਿੱਚ ਕਵਿਤਾਵਾਂ ਉਹਨਾਂ ਦੀ ਪ੍ਰਸੰਗ ਸਹਿਤ ਵਿਆਖਿਆ ਉਹ ਬਹੁਤ ਹੀ ਜ਼ਿਆਦਾ ਕਨਫਿਊਜ਼ਨ ਕਨਫਿਊਜ਼ ਕਰਦੀ ਸੀ ਮੈਨੂੰ ਕਿਉਂਕਿ ਪਹਿਲੀ ਗੱਲ ਤਾਂ ਮੇਰਾ ਇਹ ਸ ਸਬਜੈਕਟ ਨੂੰ ਪੜ੍ਹਨ 'ਚ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਰੁਝਾਨ ਨਹੀਂ ਸੀ ਕਿ ਮੈਨੂੰ ਹਿਸਟਰੀ ਪਸੰਦ ਸੀ ਮੈਂ ਹਰ ਵਕਤ ਹੀ ਹਿਸਟਰੀ ਨੂੰ ਹੀ ਪੜ੍ਹਨਾ ਪਸੰਦ ਕਰਦੀ ਸੀ ਇਸ ਸਬਜੈਕਟ ਨੂੰ ਮੈਂ ਸਿਰਫ਼ ਇੱਕ ਸਬਜੈਕਟ ਦੇ ਤੌਰ 'ਤੇ ਹੀ ਲਿਆ ਕਿ ਜਿਹਨੂੰ ਬਸ ਮੈਂ ਨੋਰਮਲੀ ਪੜ੍ਹਦੀ ਸੀ ਪਰ ਇੱਕ ਦਿਨ ਇੱਦਾਂ ਦਾ ਆਇਆ ਸੀ ਕਿ ਮੇਰੇ ਫਰੈਂਡ ਸਰਕਲ 'ਚ ਇਸ ਗੱਲ ਦੀ ਮਤਲਬ ਚਰਚਾ ਸ਼ੁਰੂ ਹੋ ਗਈ ਇਸ ਸਬਜੈਕਟ ਨੂੰ ਲੈ ਕੇ ਅਤੇ ਅਸੀਂ ਆਪਸ 'ਚ ਇਹ ਗੱਲਾਂ ਕਰਨ ਲੱਗ ਗਏ ਕਿ ਇਹਦੇ ਵਿੱਚ ਇੱਦਾਂ ਹੈ ਇੱਦਾਂ ਹੀ ਇਹੀ ਗੱਲਾਂ ਨੂੰ ਮੇਰੇ ਦਿਮਾਗ਼ 'ਚ ਰਹਿਣ ਕਰਕੇ ਮੈਂ ਘਰ ਜਾ ਕੇ ਆਪਣੇ ਪਾਪਾ ਨਾਲ ਸ਼ੇਅਰ ਕੀਤੀਆਂ ਪਾਪਾ ਨੇ ਇਸ ਸਬਜੈਕਟ ਬਾਰੇ ਮੈਨੂੰ ਬਹੁਤ ਕੁਛ ਦੱਸਿਆ ਜਿਹੜੀਆਂ ਚੀਜ਼ਾਂ ਬਾਰੇ ਮੈਨੂੰ ਨਹੀਂ ਪਤਾ ਸੀ ਉਹ ਸਭ ਕੁਝ ਸੁਣਨ ਤੋਂ ਬਾਅਦ ਮੈਂ ਸੋਚਿਆ ਕਿ ਕਿਉਂ ਨਾ ਇਸ ਬੁੱਕ ਨੂੰ ਇੱਕ ਵਾਰ ਪੜ੍ਹ ਲਿਆ ਜਾਵੇ ਕਿਤਾਬ ਨੂੰ ਪੜ੍ਹ ਕੇ ਇਹਦੇ ਵਿੱਚੋਂ ਸਿੱਖਿਆ ਜਾਵੇ ਫਿਰ ਮੈਂ ਇਸ ਕਿਤਾਬ ਨੂੰ ਪੜ੍ਹਨਾ ਸ਼ੁਰੂ ਕੀਤਾ ਹੌਲੀ ਹੌਲੀ ਇਹ ਕਿਤਾਬ ਮੇਰੀ ਫੇਵਰੇਟ ਕਿਤਾਬ ਬਣ ਗਈ ਜਿਹਦੇ ਕਰ ਕੇ ਕਿ ਮੈਂ ਪਹਿਲਾਂ ਕਦੇ ਨਹੀਂ ਸੀ ਸੋਚਿਆ ਕਿ ਮੈਂ ਇਹਦੇ ਵਿੱਚੋਂ ਸਹੀ ਪੜਾਂਗੀ ਸਹੀ ਸਿੱਖਾਂਗੀ ਸਹੀ ਕੁਛ ਕਰਾਂਗੀ ਪਰ ਜਦੋਂ ਪੜ੍ਹਨ ਤੋਂ ਬਾਅਦ ਮੈਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ ਇਹਦੇ ਵਿੱਚੋਂ ਫਿਰ ਹੌਲੀ ਹੌਲੀ ਇਹ ਮੇਰਾ ਫੇਵਰੇਟ ਸਬਜੈਕਟ ਬਣਦਾ ਗਿਆ ਜਿਸ ਕਰ ਕੇ ਕਿ ਮੈਂ ਇਲੈੱਕਟਿਵ ਪੰਜਾਬੀ ਨੂੰ ਪੜ੍ਹਨਾ ਪਸੰਦ ਕੀਤਾ ਕਿਉਂਕਿ ਇਹਦੇ ਵਿੱਚ ਬਹੁਤ ਸਾਰੀ ਹਿਸਟਰੀ ਕਹਿ ਸਕੀਏ ਕਿ ਹਿਸਟਰੀ ਨਾਲ਼ ਹੀ ਥੋੜ੍ਹੀ ਲਲੇ ਰਿਲੇਟਡ ਹੈ ਇਹਦੇ ਵਿੱਚ ਹੀਰ ਰਾਂਝਿਆਂ ਦੀਆਂ ਗੁਰੂਆਂ ਪੀਰਾਂ ਦੀਆਂ ਹੋਰ ਪੰਜਾਬੀ ਕਵਿਤਾਵਾਂ ਦੀਆਂ ਬਹੁਤ ਸਾਰੀਆਂ ਗੱਲਾਂ ਕੀਤੀਆਂ ਗਈਆਂ ਹਨ ਜਿਨ੍ਹਾਂ ਨੂੰ ਪੜ੍ਹ ਕੇ ਮੈਨੂੰ ਬਹੁਤ ਜ਼ਿਆਦਾ ਮਜ਼ਾ ਆਇਆ